ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਅਸੀਂ ਨਾ ਤਪਾ ਮੰਡੀ ਦੇ ਰਹਿਣ ਵਾਲੇ ਹੈਗੇ ਸੂਰਿਆ ਕਲੋਨੀ ਦੇ ਵਿੱਚ ਆਪਣਾ ਨਵਾਂ ਮਕਾਨ ਬਣਾਇਆ ਹੈਗਾ ਹਜੇ ਅਸੀਂ ਉੱਥੇ ਰਹਿਣ ਨਹੀਂ ਲੱਗੇ ਰਹਿਣ ਲੱਗਣਾ ਗਾ ਅਸੀਂ ਮੂਹਰਲੇ ਦਿਨਾਂ ਦੇ ਵਿੱਚ ਦੀਵਾਲੀ ਤੋਂ ਬਾਅਦ ਰਹਿਣ ਦੀ ਅਸੀਂ ਸਕੀਮ ਜਿਹੀ ਬਣਾਈ ਹੈਗੀ ਅਤੇ ਉਸ ਤੋਂ ਪਹਿਲਾਂ ਤਾਂ ਮੈਂ ਮੈਂ ਅਸੀਂ ਨਾ ਬ੍ਰਾਂਡਵਾਏ ਦਾ ਇਹਦਾ ਨਾ ਕਨੈਕਸ਼ਨ ਲੈਣਾ ਗਾ ਨੈੱਟ ਦਾ ਅਸੀਂ ਵੀ ਜੋ ਕਿਉਂਕਿ ਅਸੀਂ ਉੱਥੇ ਜਾਵਾਂਗੇ ਅਸੀਂ ਬੱਚਿਆਂ ਦੀ ਪੜ੍ਹਾਈ ਪੜੂਈ ਦਾ ਵੀ ਔਖਾ ਨਾ ਨਾ ਹੋ ਜਾਵੇ ਤਾਂ ਉਹ ਇੱਕ ਦੋ ਥਾਵਾਂ ਤੋਂ ਮੈਂ ਪਤਾ ਕੀਤਾ ਤਾਂਹੀਓ ਮੈਂ ਤੁਹਾਡੇ ਨਾਲ ਬੀ ਐਸ ਐਨ ਐਲ ਉਹ ਕਹਿੰਦੇ ਬੀ ਐਸ ਐਨ ਐਲ ਦਾ ਵੀ ਚੱਲ ਰਿਹਾ ਗਾ ਸਾਡੇ ਗੇ ਕਾਫ਼ੀ ਗੇ ਇੱਥੇ ਘਰਾਂ ਦੇ ਵਿੱਚ ਚੱਲੀ ਜਾਂਦਾ ਹੈਗਾ ਤਾਂ ਫਿਰ ਇਹਦੇ ਵਿੱਚ ਮੈਨੂੰ ਇਹ ਦੱਸੋ ਕੋਈ ਤਾਂ ਕਹਿੰਦਾ ਦੇਖੋ ਉਹਦੀ ਵੀ ਸਪੀਡ ਘੱਟ ਹੈ ਕੋਈ ਕੁਛ ਕਹਿੰਦਾ ਹਾਂਜੀ ਤੁਸੀਂ ਮੈਨੂੰ ਸਮਝਾ ਸਮਝਾਓ ਦੱਸੋ ਵੀ ਇਹ ਮੈਨੂੰ ਠੀਕ ਰਹੂਗਾ ਜਾਂ ਨਹੀਂ ਰਹੂਗਾ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਅਤੇ ਇਹਦਾ ਕ ਆਪਣਾ ਖਰਚਾ ਕਿੰਨਾ ਕੁ ਆਜੂਗਾ ਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਜੀ ਮੈਂ ਨਾ ਬੈੱਕ ਕੋਲ ਕਰਦਾ ਮੈਂ ਘਰ ਗੱਲਬਾਤ ਕਰਦਾ ਬੱਚੇ ਦੇ ਨਾਲ ਜੇ ਤਾਂ ਬੱਚਿਆਂ ਨੂੰ ਉਹ ਲੱਗੂਗਾ ਠੀਕ ਉਹ ਮੈਂ ਤੁਹਾਨੂੰ ਫਿਰ ਬਾਅਦ ਦੇ ਵਿੱਚ ਮੈਂ ਕੋਲ ਕਰਦਾ ਓਕੇ ਜੀ ਥੈਂਕ ਯੂ ਸਰ ਹਾਂਜੀ ਅੱਛਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਨੈੱਟ ਪਲਸ ਵਾਲੇ ਬੋਲਦੇ ਹੋ ਜੀ ਬਰਾਡਵੇ ਕਨੈਕਸ਼ਨ ਹਾਂਜੀ ਹਾਂਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਮੈਂ ਅਸੀਂ ਨਾ ਤਪਾ ਮੰਡੀ ਦੇ ਵਿੱਚ ਨਵਾਂ ਮਕਾਨ ਬਣਾਇਆਂ ਸੂਰਿਆ ਕਲੋਨੀ ਦੇ ਵਿੱਚ ਅਤੇ ਉਸ ਦੇ ਨਾ ਅਸੀਂ ਨੈਟ ਦਾ ਕਨੈਕਸ਼ਨ ਲੈਣਾ ਹੈਗਾ ਅਤੇ ਮੈਂ ਦੋ ਤਿੰਨ ਘਰਾਂ ਦੇ ਨਾਲ ਰਾਏ ਕੀਤੀ ਹੈ ਉਹਨਾਂ ਨੇ ਤੁਹਾਡੇ ਇਹਦੇ ਬਾਰੇ ਰਿਕਮੈਂਡ ਕੀਤਾ ਗਾ ਮੈਨੂੰ ਵੀ ਤੁਹਾਡੇ ਨਾਲ ਮੈਂ ਗੱਲ ਕਰਾਂ ਵੀ ਇਹ ਵਧੀਆ ਚੱਲਦਾ ਇਹਦੀ ਸਪੀਡ ਵਗੈਰਾ ਅੱਛੀ ਹੈ ਇਹਦੀ ਡਾਟਾ ਵਗੈਰਾ ਵਧੀਆ ਯੂਜ ਹੁੰਦਾ ਜਿਵੇਂ ਬੱਚੇ ਨੇ ਪੜ੍ਹਨਾ ਹੈਗਾ ਯੂਟੀਊਬ ਵਗੈਰਾ ਤੋਂ ਜਾਂ ਅਸੀਂ ਵਿਦੇਸ਼ ਦੇ ਵਿੱਚ ਮੇਰੇ ਭਤੀਜੇ ਨਾਲ ਗੱਲ ਕਰਨੀ ਹੁੰਦੀ ਹੈ ਤਾਂ ਸਾਨੂੰ ਫਾਸਟ ਨੈਟਵਰਕ ਦੀ ਜ਼ਰੂਰਤ ਹੈਗੀ ਐਵੇਂ ਨਾ ਦੇਖੋ ਤੁਹਾਨੂੰ ਵਾਈਫਾਈ ਜਿਹੜਾ ਬੀ ਐਸ ਐਨ ਐਲ ਵਾਲਿਆਂ ਦਾ ਹੈਗਾ ਉੱਧਰ ਵੀ ਮੈਂ ਗੱਲਬਾਤ ਕੀਤੀ ਹੈਗੀ ਤੁਹਾਡੇ ਨਾਲ ਵੀ ਅਤੇ ਤੁਸੀਂ ਵੀ ਮੈਨੂੰ ਦੱਸੋ ਇਹ ਕਿੰਨਾ ਕੁ ਖਰਚਾ ਆਜੂਗਾ ਜੀ ਕਿੰਨੇ ਮੋਡਮ ਲੱਗਣਗੇ ਤਾਰ ਵਗੈਰਾ ਦਾ ਕੀ ਖਰਚਾ ਆਜੂਗਾ ਹਾਂਜੀ ਹਾਂਜੀ ਹਾਂਜੀ ਠੀਕ ਹੈ ਓਕੇ ਜੀ ਚਲੋ ਠੀਕ ਹੈ ਜੀ ਮੈਂ ਨਾ ਰਾਏ ਕਰਕੇ ਨਾ ਘਰ ਮੈਂ ਤੁਹਾਨੂੰ ਐਪਲੀਕੇਸ਼ਨ ਦੇਵਾਂਗਾ ਅਤੇ ਫਿਰ ਮੈਂ ਤੁਹਾਡਾ ਕਨੈਕਸ਼ਨ ਅਸੀਂ ਲੈਣ ਦੇ ਬਾਰੇ ਵਿਚਾਰ ਬਣਾਉਂਦੇ ਹਾਂ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ